ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਘਰ ਪਾਣੀ ਦੀ ਸਪਲਾਈ ਬਹੁਤ ਸੁਚਾਰੂ ਢੰਗ ਨਾਲ ਆਉਂਦੀ ਹੈ ਸਾਡੇ ਘਰ ਪਾਣੀ ਦੀ ਜਿਹੜੀ ਸਪਲਾਈ ਹੈ ਉਹ ਵਾਟਰ ਬਕਸ ਤੋਂ ਆਉਂਦੀ ਹੈ ਅਤੇ ਵਾਟਰ ਵਰਕਸ ਵੀ ਪੂਰਾ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ ਬਟ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕੀ ਅੱਜ ਦੇ ਟਾਈਮ ਦੇ ਵਿੱਚ ਜੋ ਸਾਡੇ ਇਲਾਕੇ ਦੇ ਵਿੱਚ ਪਾਣੀ ਦੀ ਸਪਲਾਈ ਹੈ ਉਹ ਵਾਟਰ ਵਰਕਸ ਤੋਂ ਆਉਣੀ ਬੰਦ ਹੋ ਚੁੱਕੀ ਹੈ ਜਾਂ ਲੋਕਾਂ ਨੇ ਖੁਦ ਹੀ ਬੰਦ ਕਰ ਤੀ ਹੈ ਕਿਉਂਕਿ ਸਾਰੇ ਲੋਕ ਜੋ ਹੈ ਜ਼ਿਆਦਾਤਰ ਪਾਣੀ ਮੱਛੀ ਮੋਟਰ ਜਾਂ ਆਪਾਂ ਕਹਿ ਸਕਦੇ ਹਾਂ ਅ ਸਮਰਸੀਬਲ ਪੰਪ ਤੋਂ ਲੈ ਰਹੇ ਹਨ ਜਿਹਦਾ ਪਾਣੀ ਦਾ ਲੈਵਲ ਹੈ ਜੋ ਉਹ ਵੀ ਬਹੁਤ ਨੀਚਾ ਜਾ ਚੁੱਕਿਆ ਹੈ ਜੋ ਵੀ ਇੱਕ ਬਹੁਤ ਚਿੰਤਾ ਦੀ ਗੱਲ ਹੈ ਅਤੇ ਅਸੀਂ ਪਾਣੀ ਅਸੀਂ ਸਮ ਟੂਟੀ ਦਾ ਅ ਉਹ ਵੀ ਕਰਦੇ ਹਾਂ ਯੂਜ ਕਰਦੇ ਹਾਂ ਕਿਉਂਕਿ ਟੂਟੀ ਦਾ ਪਾਣੀ ਜੋ ਹੈ ਜਿਹੜਾ ਪਾਣੀ ਨਹਿਰੀ ਪਾਣੀ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਨਹਿਰੀ ਪਾਣੀ ਇੱਕ ਅੱਛਾ ਸੋਰਸ ਮੰਨਿਆ ਗਿਆ ਹੈ ਪਾਣੀ ਪੀਣ ਦੇ ਲਈ ਜਿਹੜਾ ਸਮਰਸੀਬਲ ਪ ਪਾਣੀ ਹੈ ਉਹ ਖਾਰਾ ਹੋ ਚੁੱਕਿਆ ਹੈ ਜਾਂ ਉਹਦਾ ਜਿਹੜਾ ਪਾਣੀ ਦਾ ਲੈਵਲ ਨੀਚੇ ਜਾ ਚੁੱਕਿਆ ਜਾ ਚੁੱਕਿਆ ਉਹ ਉਹਦੇ ਉਸ ਪਾਣੀ ਦੇ ਵਿੱਚ ਕੈਮੀਕਲਸ ਵੀ ਬਹੁਤ ਆ ਰਹੇ ਆ ਜਿਹਦੇ ਕਰਕੇ ਸਾਡੇ ਇਲਾਕੇ ਦੇ ਜਿਹੜੇ ਲੋਕ ਆ ਉਹਨਾਂ ਦੇ ਵਾਲ ਸਫੇਦ ਹੋਣੇ ਠੀਕ ਹੈ ਹੋਰ ਕਈ ਸਕਿਨ ਪ੍ਰੋਬਲਮਸ ਆ ਰਹੀਆਂ ਹਨ ਅਤੇ ਜਿਹੜਾ ਟੂਟੀ ਦੇ ਪਾਣੀ ਦੇ ਟੂਟੀ ਦੇ ਪਾਣੀ ਦੀ ਜਿਹੜੀ ਸਪਲਾਈ ਹੈ ਉਹਦੇ ਵਿੱਚ ਵੀ ਕਈ ਤਰ੍ਹਾਂ ਦੀ ਕਈ ਵਾਰੀ ਔਕੜਾਂ ਆ ਜਾਂਦੀਆਂ ਹਨ ਜਿਵੇਂ ਕਿ ਅ ਪਾਈਪ ਲੀਕੇਜ ਹੋ ਗਈ ਇੱਦਾਂ ਦੀਆਂ ਕਈ ਚੀਜ਼ਾਂ ਹੋ ਗਈਆਂ ਹਨ ਇਸ ਦੇ ਨਾਲ ਅ ਜਿਹੜਾ ਟੂਟੀ ਦੇ ਪਾਣੀ ਨਾਲ ਜਿਹੜਾ ਅ ਪ ਪੁਰਾਣੇ ਲੋਕ ਸੀ ਉਹ ਜ਼ਿਆਦਾਤਰ ਟੂਟੀ ਦਾ ਪਾਣੀ ਯੂਜ਼ ਕਰਦੇ ਸੀਗੇ ਜਿਹਦੇ ਨਾਲ ਉਹਨਾਂ ਨੂੰ ਕਦੇ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਵੇਂ ਜਿਵੇਂ ਜਿਹੜਾ ਸਮਾਂ ਬਦਲ ਰਿਹਾ ਲੋਕ ਸਮਰਸੀਬਲ ਵੱਲ ਯੂਜ਼ ਸਮਰਸੀਬਲ ਵੱਲ ਜਾ ਰਹੇ ਹਨ ਬਟ ਇਹ ਇਸ ਦੇ ਨਾਲ ਕੀ ਹੋ ਰਿਹਾ ਅ ਆਪਾਂ ਨੂੰ ਉਹ ਸੁਖਾਈ ਦੇ ਨਾਲ ਔਖਾਈ ਵੀ ਆ ਰਹੀ ਹੈ ਜਿਹੜੇ ਅ ਜਿਹੜੀ ਸਮਰਸੀਬਲ ਚੀਜ਼ਾਂ ਹੈ ਉਹਦੇ ਕਰਕੇ ਆਪਾਂ ਨੂੰ ਸਕਿਨ ਪ੍ਰੋਬਲਮਜ਼ ਹੋ ਗਈਆਂ ਇਹ ਚੀਜ਼ਾਂ ਦਾ ਬੜਾ ਡੂੰਘਾ ਪ੍ਰਭਾਵ ਪੈ ਰਿਹਾ ਹੈ